ਹਾਂਜੀ ਪੰਜਾਬੀ ਭਾਸ਼ਾ ਦਾ ਖੇਤਰ ਹੈ ਜਿਹੜਾ ਉਹਦਾ ਤਾਂ ਕੋਈ ਸ਼ੱਕ ਨਹੀਂ ਆਪਾਂ ਕਹਿ ਹੀ ਨਹੀਂ ਸਕਦੇ ਮੀਨਜ਼ ਪੰਜਾਬੀ ਭਾਸ਼ਾ ਨੇ ਕਿੱਦਾਂ ਧੂਮ ਮਚਾਈ ਹੋਈ ਹੈ ਹਰ ਜਗ੍ਹਾ 'ਤੇ ਠੀਕ ਹੈ ਮੀਨਜ਼ ਪੰਜਾਬੀ ਭਾਸ਼ਾ ਹੈ ਹੀ ਇੱਦਾਂ ਦੀ ਮਿੱਠੀ ਬੋਲੀ ਹੈ ਹਰਮਨ ਪਿਆਰੀ ਬੋਲੀ ਹੈ ਜੋ ਲੋਕਾਂ ਦਾ ਮੋਹ ਠੀਕ ਹੈ ਉਹਨਾਂ ਦਾ ਪਿਆਰ ਇੱਦਾਂ ਜਿੱਤ ਲੈਂਦੀ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਪੰਜਾਬੀ ਭਾਸ਼ਾ ਦੀ ਮਿੱਠਤ ਹੀ ਇੰਨੀ ਜ਼ਿਆਦਾ ਵੀ ਤੁਸੀਂ ਜਦੋਂ ਬੋਲਦੇ ਹੋ ਨਾ ਇੱਦਾਂ ਲੱਗਦਾ ਵੀ ਪਤਾ ਨਹੀਂ ਬਈ ਕੀ ਫੁੱਲ ਕਿਰ ਰਹੇ ਹੈ ਠੀਕ ਹੈ ਪਰ ਮੀਨਜ਼ ਇਹ 'ਚ ਕੋਈ ਸ਼ੱਕ ਵੀ ਨਹੀਂ ਹੈਗਾ ਪੰਜਾਬੀ ਭਾਸ਼ਾ ਹੈ ਹੀ ਇੰਨੀ ਵਧੀਆ ਠੀਕ ਹੈ ਕਹਿੰਦੇ ਆ ਨਾ ਪੰਜਾਬੀ ਜਿੱਥੇ ਵੀ ਜਾਂਦੇ ਆ ਛਾ ਜਾਂਦੇ ਆ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਇੰਨੀ ਜ਼ਿਆਦਾ ਮਾਨਤਾ ਮਿਲੀ ਹੋਈ ਹੈ ਤੁਸੀਂ ਪੂਰੇ ਪੰਜਾਬ 'ਚ ਦੇਖ ਲਓ ਪੰਜਾਬੀ ਕੜ੍ਹਾ ਹੋਇਆ ਦੂਰੋਂ ਹੀ ਦਿਖ ਜਾਊਗਾ ਪੂਰੇ ਦੇਸ਼ ਵਿੱਚ ਜੇ ਦੇਸ਼ ਨੂੰ ਦੇਖੋਗੇ ਤਾਂ ਪੰਜਾਬੀ ਤੁਹਾਨੂੰ ਦੂਰੋਂ ਖਡ੍ਹਿਆ ਹੀ ਦਿਸ ਜੂਗਾ ਠੀਕ ਹੈ ਪੰਜਾਬ ਦੀ ਜਿਹੜੀ ਭਾਸ਼ਾ ਅਤੇ ਪੰਜਾਬ ਦਾ ਭਾਸ਼ਾ ਨੇ ਹੀ ਲੋਕ ਵਿਕਾਸ ਇੰਨਾ ਕੀਤਾ ਠੀਕ ਹੈ ਸੋਚ ਵੀ ਨਹੀਂ ਸਕਦੇ ਆਪਾਂ ਪੰਜਾਬੀ ਭਾਸ਼ਾ ਮਿੱਠੀ ਹਰਮਨ ਪਿਆਰੀ ਭਾਸ਼ਾ ਹੈਗੀ ਹੈ ਠੀਕ ਹੈ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਕੀ ਹਰ ਜਗ੍ਹਾ 'ਤੇ ਧੁੰਮ ਮਚਾਈ ਹੋਈ ਹੈ ਇੱਥੋਂ ਤੱਕ ਕਿ ਤੁਸੀਂ ਬਾਹਰ ਵੀ ਜਾਂਦੇ ਹੋ ਨਾ ਫੋਰਨ ਕੰਟਰੀਆਂ ਦੇ ਵਿੱਚ ਵੀ ਪੰਜਾਬ ਨੇ ਇੰਨੀ ਧੂੰਮ ਮਚਾਈ ਹੋਈ ਹੈ ਪੰਜਾਬੀ ਭਾਸ਼ਾ ਨੇ ਇੰਨੀ ਧੂੰਮ ਮਚਾਈ ਹੋਈ ਹੈ ਪੰਜਾਬੀ ਭਾਸ਼ਾ ਬੋਲਣ ਵਾਲਾ ਇਨਸਾਨ ਦੂਰੋਂ ਹੀ ਦਿਖ ਜਾਂਦਾ ਠੀਕ ਹੈ ਅਤੇ ਇੰਨੀ ਮਿੱਠਤ ਹੁੰਦੀ ਹੈ ਉਹਦੇ ਬੋਲਣ ਵਿੱਚ ਫਿਰ ਇਸ ਚੀਜ਼ 'ਚ ਕੋਈ ਸ਼ੱਕ ਨਹੀਂ ਵੀ ਇਹ ਭਾਸ਼ਾ ਸਾਡੇ ਗੁਰੂਆਂ ਦੀ ਠੀਕ ਹੈ ਸਾਡੇ ਪੀਰਾਂ ਦੀ ਸਾਡੇ ਸ਼ਹੀਦ ਸਾਹਿਬਜਾਦੇ ਆ ਜਿਹੜੇ ਠੀਕ ਹੈ ਉਹਨਾਂ ਦੀ ਸ਼ਹਾਦਤ ਦਿੱਤੀ ਹੋਈ ਹੈ ਠੀਕ ਹੈ ਮੀਨਜ਼ ਉਹਨਾਂ ਨੇ ਕਾਇਮ ਰੱਖਿਆ ਹੋਇਆ ਇਸ ਚੀਜ਼ ਨੂੰ ਠੀਕ ਹੈ ਬਹੁਤ ਆਜ਼ਾਦੀ ਲਈ ਸਭ ਤੋਂ ਵੱਡਾ ਯੋਗਦਾਨ ਹੈ ਠੀਕ ਹੈ ਮੀਨਜ਼ ਆਪਾਂ ਸੋਚ ਨਹੀਂ ਸਕਦੇ ਠੀਕ ਹੈ ਇਸ ਭਾਸ਼ਾ ਨੂੰ ਬਹੁਤ ਹੀ ਲੋਕਾਂ ਨੂੰ ਇੱਕ ਪਿਆਰ ਭਰੀ ਹਰਮਨ ਭਰੀ ਇੱਕ ਪਰਮਾਤਮਾ ਦੀ ਕਹਿ ਦਿਓ ਗਿਫਟ ਦਿੱਤੀ ਹੈ ਚਾਹੇ ਕੁਝ ਵੀ ਲਗਾ ਲਓ ਠੀਕ ਹੈ ਪੰਜਾਬੀ ਭਾਸ਼ਾ ਹੈ ਹੀ ਇੱਦਾਂ ਦੀ ਠੀਕ ਹੈ ਮੀਨਜ਼ ਇਹਦਾ ਤੇ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਇਹਦਾ ਤੇ ਜ਼ਿਕਰ ਹੀ ਇਨਾਂ ਵਧੀਆ ਹੈ ਠੀਕ ਹੈ ਬੋਲਣ 'ਤੇ ਹੀ ਪਤਾ ਲੱਗ ਜਾਂਦਾ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਤਾਂ ਆਪਾਂ ਕੁਝ ਮੀਨਜ਼ ਇਹ ਨੇ ਇਸੇ ਲਈ ਇੰਨਾਂ ਪ੍ਰਭਾਵਿਤ ਕੀਤਾ ਨਾ ਬਹੁਤ ਹੀ ਜ਼ਿਆਦਾ ਤੁਹਾਨੂੰ ਦੱਸ ਵੀ ਨਹੀਂ ਸਕਦੇ ਅਸੀਂ ਥੈਂਕ ਯੂ